ਚਾਰ ਲੱਖ ਬਾਰ੍ਹਾਂ ਹਜ਼ਾਰ ਚਾਰ ਸੌ ਬਾਹਠ ਪੰਜ ਲੱਖ ਚੁਤਾਲ਼ੀ ਹਜ਼ਾਰ ਚਾਰ ਸੌ ਚੁਤਾਲ਼ੀ ਛੇ ਲੱਖ ਬਾਈ ਹਜ਼ਾਰ ਦੋ ਸੌ ਬਾਈ ਦੋ ਲੱਖ ਗਿਆਰ੍ਹਾਂ ਹਜ਼ਾਰ ਇੱਕ ਸੌ ਬਾਰ੍ਹਾਂ ਨੌ ਲੱਖ ਬਾਰ੍ਹਾਂ ਹਜ਼ਾਰ ਇੱਕ ਸੌ ਅਠਾਸੀ